ਹੈਲੋ ਹਾਂਜੀ ਕੀ ਹਾਲ ਹੈ ਜੀ ਪਛਾਣ ਲਿਆ ਜੀ ਮੈਂ ਆਖਿਆ ਕੀ ਪਤਾ ਗਰੀਬਾਂ ਦਾ ਨੰਬਰ ਤੁਸੀਂ ਫੀਡ ਕੀਤਾ ਹੋਵੇ ਕਿ ਨਾ ਕੀਤਾ ਹੋਵੇ ਜੀ ਹੋਰ ਠੀਕ ਠਾਕ ਜੀ ਬਸ ਟਾਈਮ ਹੀ ਨੀਂ ਲੱਗਿਆ ਜੀ ਕੌਣ ਆਵਾਂਗੇ ਕੱਲ ਨੂੰ ਆਵਾਂਗੇ ਅਸੀਂ ਜੀ ਹਾਂਜੀ ਓ ਆਈ ਜਾਨੇ ਜੀ ਰਾਹ ਚ ਈ ਇਹ ਤਾਂ ਮਜ਼ਾਕ ਕਰੀ ਜਾਨੇ ਅਸੀਂ ਤਾਂ ਫਸੇ ਖੜੇ ਆਂ ਇਥੇ ਟ੍ਰੈਫਿਕ ਹੀ ਬਹੁਤ ਜਿਆਦਾ ਜੀ ਫਾਟਕਾਂ ਕੋਲ ਖੜੇ ਫਾਟਕ ਬੰਦ ਪਿਆ ਜੀ ਅਸੀਂ ਪਹਿਲਾਂ ਪੁਲ ਉਤੋਂ ਦੀ ਆਉਂਦੇ ਹੀ ਸਾਨੂੰ ਪਤਾ ਨਹੀਂ ਸੀ ਜੀ ਅਸੀਂ ਇੱਧਰ ਫਸਗੇ ਫਾਟਕਾਂ ਆਲੇ ਪਾਸੇ ਨਹੀਂ ਸਾਨੂੰ ਪਤਾ ਨਹੀਂ ਸੀ ਨਾ ਜੀ ਮੈਂ ਕਿਹਾ ਚਲ ਜਾਣੇ ਆਹਾਂ ਓਹ ਫਾ ਫਾਟਕਾਂ ਵਾਲੇ ਪਾਸੇ ਵੜਗੇ ਉਧਰ ਟ੍ਰੈਫਿਕ ਹੀ ਬਹੁਤ ਹਾਂਜੀ ਹੈ ਨਾ ਇੱਕ ਸਕੂਲ ਬਹੁਤ ਔਖਾ ਸਕੂਲ ਦੇ ਬੱਚਿਆਂ ਕਰਕੇ ਟ੍ਰੈਫਿਕ ਬਹੁਤ ਹੋ ਜਾਂਦਾ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਤੁਹਾਡੀ ਪਹਿਲਾਂ ਵੀ ਐਕਸੀਡੈਂਟ ਹੋਇਆ ਇੱਕ ਸਕੂਟਰੀ 'ਤੇ ਕੁੜੀ ਜਾਈ ਜਾਂਦੀ ਸੀ ਉਹਨੇ ਹੱਥ ਕੱਢਿਆ ਨਹੀਂ ਇੰਡੀਕੇਟਰ ਛੱਡ ਦਿੱਤਾ ਉਹਨੇ ਉਹਨੇ ਇੰਡੀਗੇਟਰ ਵੇਖਿਆ ਨਹੀ ਅਤੇ ਸਿੱਧੀ ਵਿੱਚ ਮਾਰੀ ਉਹਨੇ ਜੀ ਬਹੁਤ ਜ਼ਿਆਦਾ ਹਾਂਜੀ ਹੈਗਾ ਹੁਣ ਤਾਂ ਚਲਾਨ ਚਲੂਨ ਕੱਟੀ ਜਾਂਦੇ ਵੈਸੇ ਇਸੇ ਕਰਕੇ ਵੀ ਹੋਰ ਨਹੀਂ ਪੁਲਿਸ ਵਾਲੇ ਦੇ ਫਿਰ ਸਪਾਰਸ਼ ਪਾ ਕੇ ਫੇਰ ਫੋਨ ਕਰਵਾ ਦਿੰਦੇ ਫਿਰ ਚਲੇ ਜਾਂਦੇ ਆ ਬੁਰਾ ਹਾਲ ਹੀ ਆ ਨਾ ਚਲਾਨ ਤਾਂ ਕਰਦੇ ਨੀ ਪੈਸੇ ਦੇ ਦਓ ਉੱਥੇ ਹੀ ਕਰਦੇ ਚਲਾਨ ਚਲੁਨ ਤਾਂ ਕੱਟਦੇ ਹੀ ਨਹੀ

ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਹੈ ਰਾਹ 'ਚ ਹੀ ਆਂ ਅਸੀਂ ਤੁਹਾਡੇ ਕੋਲ ਆਵਾਂਗੇ ਟ੍ਰੈਫਿਕ ਬਸ ਟ੍ਰੈਫਿਕ ਕਰਕੇ ਫਸ ਗਏ ਜੀ ਚਲੋ ਫਿਰ ਤੁਹਾਨੂੰ ਦੱਸਦੇ ਹਾਂ ਅਸੀਂ ਜਾ ਕੇ ਜੀ ਪਹੁੰਚ ਕੇ ਠੀਕ ਹੈ ਜੀ